ਅੱਜ ਦੇ ਯੁੱਗ ਵਿੱਚ ਤਕਨੋਲਜੀ ਵਿੱਚ ਬਹੁਤ ਤਰੱਕੀ ਹੋਈ ਹੈ ਇਸ ਤਕਨੋਲਜੀ ਦੀ ਕਾਢ ਸਮਾਰਟਫੋਨ ਹੈ ਸਮਾਰਟਫੋਨ ਕਾਰਣ ਸਾਨੂੰ ਹਰ ਇੱਕ ਚੀਜ਼ ਬਹੁਤ ਹੀ ਅਸਾਨ ਹੋ ਗਈ ਹੈ ਸਮਾਰਟਫੋਨ ਰਾਹੀ ਅਸੀਂ ਹਰ ਕੰਮ ਘਰ ਬੈਠੇ ਹੀ ਕਰ ਸਕਦੇ ਹਾਂ ਸਾਨੂੰ ਟਿਕਟ ਲੈਣ ਲਈ ਲਾਈਨਾਂ ਵਿੱਚ ਖੜੇ ਹੋਣਾ ਪੈਂਦਾ ਸੀ ਪਰ ਹੁਣ ਅਸੀਂ ਘਰ ਬੈਠੇ ਹੀ ਸਮਾਰਟਫੋਨ ਰਾਹੀਂ ਔਨਲਾਈਨ ਬੁਕਿੰਗ ਕਰ ਸਕਦੇ ਹਾਂ ਔਨਲਾਈਨ ਬੁਕਿੰਗ ਕਰਨ ਦੇ ਬਹੁਤ ਫ਼ਾਇਦੇ ਹਨ ਸਮਾਰਟਫੋਨ ਰਾਹੀਂ ਅਸੀਂ ਔਨਲਾਈਨ ਖਾਣਾ ਵੀ ਮੰਗਵਾ ਸਕਦੇ ਹਾਂ ਘਰ ਬੈਠੇ ਅਸੀਂ ਆਪਣੇ ਮਨ ਪਸੰਦ ਕੋਈ ਵੀ ਚੀਜ਼ ਔਨਲਾਈਨ ਮੰਗਵਾ ਕੇ ਖਾ ਸਕਦੇ ਹਾਂ ਸਮਾਰਟਫੋਨ ਰਾਹੀਂ ਅਸੀਂ ਪੇਮੈਂਟ ਔਨਲਾਈਨ ਕਰ ਸਕਦੇ ਹਾਂ ਅਸੀਂ ਘਰ ਬੈਠੇ ਇੱਥੋਂ ਹੀ ਕਿਸੇ ਨਾਲ ਵੀ ਬੜੇ ਆਰਾਮ ਨਾਲ ਬਿਨਾਂ ਕਿਤੇ ਗਏ ਘਰ ਬੈਠੇ ਗੱਲ ਕਰ ਸਕਦੇ ਹਾਂ ਅਸੀਂ ਸਮਾਰਟਫੋਨ ਰਾਹੀ ਹੁਣ ਬਿਜਲੀ ਦੇ ਬਿੱਲ ਔਨਲਾਈਨ ਭੁਗਤਾਨ ਕਰ ਸਕਦੇ ਹਾਂ ਔਨਲਾਈਨ ਖਰੀਦਦਾਰੀ ਕਰ ਸਕਦੇ ਹਾਂ ਅਸੀਂ ਕਿਸੇ ਵੀ ਚੀਜ਼ ਬਾਰੇ ਜਾਣਕਾਰੀ ਔਨਲਾਈਨ ਪ੍ਰਾਪਤ ਕਰ ਸਕਦੇ ਹਾਂ ਸਾਨੂੰ ਬਾਹਰੋਂ ਕਿਤੇ ਵੀ ਜਾਣ ਦੀ ਲੋੜ ਨਹੀਂ